ਹਾਂਜੀ ਹਾਂਜੀ ਮੇਰੇ ਕੋਲ ਇੱਕ ਹੈਗੀ ਫੋਟੋਆਂ ਦੀ ਪੁਰਾਣੀ ਹਾਰਟ ਕਾਪੀ ਮੇਰੇ ਕੋਲ ਬਹੁਤ ਸਾਰੀਆਂ ਮੇਰੀਆਂ ਪੁਰਾਣੀਆਂ ਫੋਟੋਜ਼ ਪਈਆਂ ਹੋਈਆਂ ਮੇਰੇ ਬਚਪਨ ਦੀਆਂ ਫੋਟੋਜ਼ ਮੇਰੇ ਸਕੂਲ ਟਾਈਮ ਦੀਆਂ ਫੋਟੋਜ਼ ਜਾਂ ਮੇਰੀ ਮੈਰਿਜ਼ ਦੀਆਂ ਫੋਟੋ ਐਲਬਮ ਸਾਰੀਆਂ ਮੇਰੇ ਕੋਲ ਪਈਆਂ ਹੋਈਆਂ ਉਹਨਾਂ ਉਹ ਵਾਲ਼ੀਆਂ ਫੋਟੋਜ਼ 'ਤੇ ਅੱਜ ਕੱਲ੍ਹ ਜਿਹੜੀਆਂ ਨਵੀਆਂ ਡਿਜੀਟਲ ਫੋਟੋਜ਼ ਹੈ ਬਹੁਤ ਜ਼ਮੀਨ ਆਸਮਾਨ ਦਾ ਫ਼ਰਕ ਆ ਪੁਰਾਣੀਆਂ ਫੋਟੋਆਂ ਦੇ ਵਿੱਚ ਤੁਹਾਨੂੰ ਰਿਐਲਿਟੀ ਵੱਧ ਮਿਲਦੀ ਸੀ ਅੱਜ ਕੱਲ੍ਹ ਹੈ ਕਿ ਅਸੀਂ ਆਸ ਕਈ ਫਿਲਟਰ ਵਗੈਰਾ ਲਗਾ ਲੈਂਦੇ ਹਾਂ ਜਾਂ ਕੋਈ ਕੁਛ ਲਗਾ ਲੈਂਦੇ ਹਾਂ ਮਤਲਬ ਦਿਖਾਵਾ ਵੱਧ ਹੈ ਜੋ ਪੁਰਾਣੀਆਂ ਫੋਟੋਆਂ ਸੀਗੀਆਂ ਉਹਨਾਂ ਦੇ ਵਿੱਚ ਜੋ ਅਸਲੀਅਤ ਸੀਗੀ ਉਹੀ ਹੈ ਸੋ ਮੈਨੂੰ ਪੁਰਾਣਾ ਪੁਰਾਣੀਆਂ ਫੋਟੋਆਂ ਬਹੁਤ ਪਸੰਦ ਆ ਅਕਸਰ ਮੈਂ ਉਹ ਕੱਢ ਕੇ ਆਪਣੀ ਐਲਬਮਸ ਦੇਖਦੀ ਹੁੰਦੀ ਹਾਂ ਅਤੇ ਉਹ ਵਧੇਰੇ ਭਾਵਨਾਤਮਕ ਲੱਗਦੀਆਂ ਜਾਂ ਯਥਾਰਥ ਦੇ ਨੇੜੇ ਜਾਂ ਰਿਐਲਿਟੀ ਦੇ ਨੇੜੇ ਕਹਿ ਲਉ ਸੋ ਅੱਜ ਕੱਲ੍ਹ ਦਿਖਾਵੇ ਕਰਕੇ ਬਸ ਲੋਕ ਜਸਟ ਫੋਟੋ ਖਿਚਵਾਉਣ ਲਈ ਹੀ ਮਤਲਬ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਉਸ ਟਾਈਮ ਆਮ ਜ਼ਿੰਦਗੀ 'ਚ ਉ ਉਹ ਜਿਹਾ ਨਹੀਂ ਵਿਚਰਦੇ ਹੈਗੇ ਜਿਵੇਂ ਉਹ ਫੋਟੋ ਖਿਚਵਾਉਣ ਵੇਲੇ ਕਰਦੇ ਆ ਸੋ ਮੈਨੂੰ ਪੁਰਾਣਾ ਜਿਹੜਾ ਉਹ ਸਟਾਈਲ ਸੀਗਾ ਉਹ ਅੱਜ ਵੀ ਪਸੰਦ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਹ ਉਹਨੂੰ ਹੀ ਬਰਕਰਾਰ ਰੱਖਿਆ ਜਾਂਦਾ ਰਿਐਲਟੀ ਨੂੰ ਹੀ ਸੋ ਨਵੀਆਂ ਨਵੀਆਂ ਖੋਜਾਂ ਦੇ ਨਾਲ਼ ਜਿਹੜਾ ਦਿਖਾਵਾ ਦਾ ਜਿਹੜਾ ਜ਼ਿਆਦਾ ਵੱਧ ਗਿਆ ਹੋਇਆ ਸੋ ਮੈਨੂੰ ਪੁਰਾਣਾ ਹੀ ਸਟਾਈਲ ਪਸੰਦ ਹੈ ਜੀ